ਅਸੀਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਇਸ ਲਈ ਅਸੀਂ ਆਪਣੇ ਧਾਰਮਿਕ ਸਥਾਨ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਇੱਕ ਕਾਰ ਬੁੱਕ ਕਰਨੀ ਹੈ ਅਤੇ ਉਸ ਕਾਰ ਦਾ ਨਾਂ ਟਵੈਰਾ ਹੈ ਅਤੇ ਟਵੈਰਾ ਦੇ ਲਈ ਤੁਸੀਂ ਕਿੰਨਾ ਰੈਂਟ ਲਊਂਗੇ ਕਿਰਾਏ ਦਾ ਅਤੇ ਹਰਿਮੰਦਰ ਸਾਹਿਬ ਜਾਂਦੇ ਰਸਤੇ ਵਿੱਚ ਜੋ ਵੀ ਧਾਰਮਿਕ ਸਥਾਨ ਜਾਂ ਘੁੰਮਣ ਯੋਗ ਜਗ੍ਹਾ ਆਉਣਗੀਆਂ ਅਤੇ ਉਹ ਉਹਨਾਂ ਬਾਰੇ ਜੇਕਰ ਤੁਹਾਨੂੰ ਦਾ ਜਾਣਕਾਰੀ ਹੈ ਅਤੇ ਤੁਸੀਂ ਓ ਇੱਕ ਡਰਾਵਰ ਦੇ ਰੂਪ ਵਿੱਚ ਉਹ ਵੀ ਸਾਨੂੰ ਘੁਮਾਉਂਗੇ ਤਾਂ ਉਹਦੇ ਲਈ ਵੀ ਤੁਸੀਂ ਕਿੰਨਾ ਕਿਰਾਇਆ ਲਉਂਗੇ ਅਤੇ ਕਿਹੜੀ ਕਿਹੜੀ ਜਗ੍ਹਾ ਲੈ ਕੇ ਜਾਉਂਗੇ ਇਹ ਵੀ ਸਾਨੂੰ ਦੱਸ ਦਿਓ ਅਤੇ ਇਸ ਇਸ ਦੇ ਲਈ ਅਸੀਂ ਬਾਰਾਂ ਮੈਂਬਰ ਹਾਂ ਅਤੇ ਜੋ ਅਸੀਂ ਬੱਚਿਆਂ ਨੂੰ ਛੁੱਟੀਆਂ ਕਰਕੇ ਉਹਨਾਂ ਨੂੰ ਘੁੰਮਾਉਣ ਲਿਜਾਣਾ ਚਾਹੁੰਦੇ ਹਾਂ ਅਤੇ ਆਪਣਾ ਧਾਰਮਿਕ ਸਥਾਨ ਦਿਖਾ ਕੇ ਲਿਆਉਣਾ ਚਾਹੁੰਦੇ ਹਾਂ ਅਤੇ ਇਸ ਦੇ ਨਾਲ ਸਾਨੂੰ ਵੀ ਇੱਕ ਗੱਡੀ ਚਾਹੀਦੀ ਹੈ ਅਤੇ ਉਹਦੇ ਲਈ ਗੱਡੀ ਬਿਲਕੁਲ ਸ਼ਾਨਦਾਰ ਹੋਣੀ ਚਾਹੀਦੀ ਹੈ ਅਤੇ ਉਹ ਵੀ ਉਹਦੀ ਮੁਰੰਮਤ ਵੀ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਾਂ ਨੂੰ ਆਉਂਦੇ ਜਾਂਦੇ ਟੈਮ ਕਿਤੇ ਰਾਤ ਪੈ ਜਾਵੇ ਤਾਂ ਉਹ ਰਾਹ ਦੇ ਵਿੱਚ ਨਾ ਰੁਕੇ ਅਤੇ ਜਿਹੜਾ ਵੀ ਉਹਦਾ ਡਰਾਇਵਰ ਆ ਉਹ ਵੀ ਇੱਕ ਚੰਗਾ ਹੋਣਾ ਚਾਹੀਦਾ ਗਾ ਅਤੇ ਜੋ ਕਿ ਵੀ ਆਪਾਂ ਨੂੰ ਹਰ ਥਾਂ ਘੁੰਮਾ ਕੇ ਲਿਆ ਸਕੇ ਅਤੇ ਜਿਸ ਨੂੰ ਹਰ ਜਗ੍ਹਾ ਬਾਰੇ ਪੂਰੀ ਜਾਣਕਾਰੀ ਹੋਵੇ ਅਤੇ ਉਹ ਇਸ ਜਾਣਕਾਰੀ ਦੇ ਵੀ ਆਪਣੇ ਅਲੱਗ ਇੱਕ ਗਾਈਡ ਕਰੇ ਅਤੇ ਉਹ ਇਸ ਗਾਈਡ ਲਈ ਵੀ ਅਲੱਗ ਪੈਸੇ ਲੈ ਲਵੇ ਅਤੇ ਸਹੀ ਰੇਟ ਵੀ ਸਾਨੂੰ ਅਤੇ ਸਹੀ ਗੱਡੀ ਦਾ ਕਿੰਨਾ ਇਸ ਲਈ